ਸਤਿ ਸ਼੍ਰੀ ਅਕਾਲ ਜੀ ਸ਼ਾਮ ਢਾਬੇ ਤੋਂ ਬੋਲਦੇ ਹੋ ਜੀ ਮੈਨੂੰ ਤੁਹਾਡੇ ਬਾਰੇ ਪਤਾ ਲੱਗਿਆ ਤੁਹਾਡੇ ਰੈਸਟੋਰੈਂਟ ਬਾਰੇ ਪਤਾ ਲੱਗਿਆ ਇੱਥੇ ਸਾਰਿਆਂ ਨਾਲੋਂ ਵਧੀਆ ਚੀਜ਼ਾਂ ਮਿਲਦੀਆਂ ਮੈਨੂੰ ਮੇਰੇ ਮਿੱਤਰ ਨੇ ਦੱਸਿਆ ਮੈਂ ਚਾਹੁੰਦਾ ਤੁਹਾਡੇ ਕੋਲ ਕੀ ਚੀਜ਼ ਵਧੀਆ ਮਿਲਦੀ ਥੋੜ੍ਹਾ ਜਿਹਾ ਮੈਨੂੰ ਦੱਸੋ ਮੈਨੂੰ ਇੱਥੇ ਪਤਾ ਲੱਗਿਆ ਵੀ ਰਸਗੁੱਲੇ ਵਧੀਆ ਮਿਲਦੇ ਹਨ ਮੈਨੂੰ ਕਿਰਪਾ ਕਰਕੇ ਇੱਕ ਪਲੇਟ ਰਸਗੁੱਲੇ ਭੇਜੇ ਜਾਣ ਮੇਰਾ ਅਡਰੈਸ ਗਹਿਰੀ ਭਾਗੀ ਫੋਨ ਨੰਬਰ ਨੌਂ ਅੱਠ ਅੱਠ ਅੱਠ ਅੱਠ ਨੌਂ ਨੌਂ ਦੋ ਪੰਜ ਜੀਰੋ ਮੈਨੂੰ ਭੇਜ ਦਿੱਤੇ ਜਾਣ